ਮੈਂ ਰੂਪਨਗਰ ਸ਼ਹਿਰ ਵਿੱਚ ਰਹਿੰਦੀ ਹਾਂ ਜਿੱਥੇ ਕਿ ਆਵਾਜਾਈ ਬਹੁਤ ਹੀ ਜ਼ਿਆਦਾ ਖਰਾਬ ਹੈ ਇਸ ਤਰ੍ਹਾਂ ਸਾਡੇ ਰਾਜ ਦੇ ਵਿੱਚ ਵੀ ਸੇਮ ਹੈ ਇੱਥੇ ਵੀ ਬਸ ਟਰੇਨ ਸਾਰਿਆਂ ਦੇ ਹਾਲਾਤ ਬਹੁਤ ਬੁਰੇ ਹਨ ਆਵਾਜਾਈ ਦੇ ਸਾਧਨ ਸਾਰੇ ਹੀ ਬਹੁਤ ਹੀ ਸ਼ੋਰ ਮਚਾਉਂਦੇ ਹਨ ਅਸੀਂ ਇਸ ਵਿੱਚ ਯਾਤਰਾ ਕਰਨਾ ਜ਼ਿਆਦਾ ਪਸੰਦ ਨਹੀਂ ਕਰਦੇ ਕਿਉਂਕਿ ਇਸ ਵਿੱਚ ਬਹੁਤ ਹੀ ਜ਼ਿਆਦਾ ਆਵਾਜ਼ਾਂ ਆਉਂਦੀਆਂ ਹਨ ਇਹ ਸਾਫ ਸੁਥ ਸੁਥਰਾ ਵੀ ਹੁੰਦਾ ਹੈ ਪਰ ਜ਼ਿਆਦਾ ਅੱਛਾ ਨਹੀਂ ਹੁੰਦੀ ਮੈਟਰੋ ਰੇਲਜ਼ ਅੱਛੀਆਂ ਹੁੰਦੀਆਂ ਹਨ ਪਰ ਜਿਹੜੇ ਬਸ ਵਗੈਰਾ ਆਉਂਦੀਆਂ ਹਨ ਇਨ੍ਹਾਂਂ ਦੇ ਵਿੱਚ ਸਫਾਈ ਦੀ ਅਤੇ ਸੁਰੱਖਿਆ ਦੀ ਜ਼ਿਆਦਾ ਅਸੀਂ ਗਰੰਟੀ ਨਹੀਂ ਲੈ ਸਕਦੇ ਪਰ ਇਹਨਾਂ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਆਉਣ ਵਾਲੀ ਪੀੜ੍ਹੀ ਹੈ ਜੋ ਉਹ ਇਹਨਾਂ ਰਾਹੀਂ ਹੀ ਸਫਰ ਕਰਦੀ ਹੈ ਅਤੇ ਬਸ